ਹੈਲੋ ਫਲਿੱਪਕਾਰਟ ਇੱਕ ਹਫਤਾ ਪਹਿਲਾਂ ਮੈਂ ਤੁਹਾਡੇ ਕੋਲ ਇੱਕ ਨਾਵਲ ਜਿਸ ਦਾ ਨਾਮ ਏਹੁ ਹਮਾਰਾ ਜੀਵਣਾ ਹੈ ਜੋ ਕਿ ਦਲੀਪ ਕੌਰ ਟਿਵਾਣਾ ਨੇ ਲਿਖਿਆ ਹੋਇਆ ਹੈ ਉਹ ਆਰਡਰ ਕੀਤਾ ਸੀ ਅਤੇ ਇਹ ਮੈਨੂੰ ਮਿਲ ਗਿਆ ਹੈ ਮੈਂ ਇਸ ਨੂੰ ਪਾ ਕੇ ਬਹੁਤ ਖੁਸ਼ ਹਾਂ ਜਦੋਂ ਮੈਂ ਇਸ ਨੂੰ ਖੋਲ੍ਹਿਆ ਅਤੇ ਇਹ ਇੱਕ ਬਹੁਤ ਹੀ ਸ਼ਾਨਦਾਰ ਨਾਵਲ ਦਿਖਿਆ ਅਤੇ ਇਸ ਦਾ ਕੰਟੈਂਨਟ ਬਹੁਤ ਹੀ ਵਧੀਆ ਹੈ ਧੰਨਵਾਦ